ਮੈਂ ਇਤਿਹਾਸਕ ਸਥਾਨ ਜਿਵੇਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਫਤਿਹਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੋ ਕਿ ਸਿੱਖ ਧਰਮ ਦੇ ਰਿਲੇਟਡ ਹਨ ਮੈਂ ਉੱਥੇ ਜਾਣਾ ਬਹੁਤ ਪਸੰਦ ਕਰਦਾ ਮੈਨੂੰ ਉੱਥੇ ਜਾ ਕੇ ਬਹੁਤ ਖੁਸ਼ੀ ਮਿਲਦੀ ਹੈ ਅਤੇ ਇਸ ਤੋਂ ਇਲਾਵਾ ਪਹਾੜ ਜਿਵੇਂ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਮਨਾਲੀ ਅਤੇ ਡਲਹੌਜ਼ੀ ਹਨ ਉਹ ਦਿਲ ਨੂੰ ਦੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪ੍ਰਦਾਨ ਕਰਦੇ ਹਨ ਉੱਥੇ ਜਾ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ ਜਿਵੇਂ ਕਿ ਮੈਂ ਦੋ ਤੋਂ ਤਿੰਨ ਵਾਰ ਮਨਾਲੀ ਅਤੇ ਡਲਹੌਜ਼ੀ ਗਿਆ ਹਾਂ ਉੱਥੇ ਜਾ ਕੇ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਕਿ ਪੰਜਾਬ ਦੇ ਵਿੱਚ ਗਰਮੀ ਹੁੰਦੀ ਹੈ ਤਾਂ ਮੈਂ ਘੁੰਮਣ ਦੇ ਲਈ ਮਨਾਲੀ ਜਾਂ ਡਲਹੌਜ਼ੀ ਚਲਾ ਜਾਂਦਾ ਹਾਂ ਕਿਉਂਕਿ ਉਹ ਪੰਜਾਬ ਤੋਂ ਜ਼ਿਆਦਾ ਦੂਰ ਨਹੀਂ ਹਨ ਇਸ ਤੋਂ ਇਲਾਵਾ ਰਿਸ਼ਤੇਦਾਰਾਂ ਦੇ ਵਿੱਚ ਮੇਰੇ ਮਾਮਾ ਜੀ ਦੇ ਘਰ ਮੈਂ ਬਹੁਤ ਜਾਂਦਾ ਹਾਂ ਹਫਤੇ ਦੇ ਵਿੱਚ ਇੱਕ ਤੋਂ ਦੋ ਵਾਰ ਮੈਂ ਉਹਨਾਂ ਦੇ ਘਰ ਚਲਾ ਜਾਂਦਾ ਹਾਂ ਮੇਰਾ ਮੇਰੇ ਮਾਮਾ ਜੀ ਦੇ ਨਾਲ ਬਹੁਤ ਹੀ ਜ਼ਿਆਦਾ ਲਗਾਵ ਹੈ ਇਸ ਲਈ ਮੈਂ ਉਹਨਾਂ ਦੇ ਘਰ ਹਫਤੇ ਦੇ ਵਿੱਚ ਇੱਕ ਤੋਂ ਦੋ ਵਾਰ ਜ਼ਰੂਰ ਚਲਾ ਜਾਂਦਾ ਅਤੇ ਮੰਦਰ ਜਿਵੇਂ ਕਿ ਹਿੰਦੂ ਰਿਲੀਜਨ ਦੇ ਰਿਲੇਟਡ ਪਟਿਆਲਾ ਦੇ ਵਿੱਚ ਕਾਲੀ ਮਾਤਾ ਦਾ ਮੰਦਰ ਬਣਿਆ ਹੋਇਆ ਹੈ ਮੈਂ ਉੱਥੇ ਵੀ ਇਕ ਤੋਂ ਦੋ ਵਾਰ ਗਿਆ ਹਾਂ ਉਹ ਵੀ ਕਾਫੀ ਜਗ੍ਹਾ ਬਣੀ ਹੋਈ ਹੈ ਅਤੇ ਦਿਲ ਨੂੰ ਇੱਕ ਜਾਣਾ ਚੰਗਾ ਲੱਗਦਾ ਹੈ